ਸਾਡੇ ਖੇਤਰ ਵਿੱਚ ਬਹੁਤ ਥਾਂਵ ਥਾਵਾਂ ਹਨ ਜਿੱਥੇ ਸੈਲਾਨੀ ਘੁੰਮਣ ਆ ਸਕਦੇ ਹਨ ਇਨ੍ਹਾਂ ਵਿੱਚ ਧਾਰਮਿਕ ਅਸਥਾਨ ਸ਼ਾਮਿਲ ਹਨ ਜਿਸ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸੈਲਾਨੀ ਆ ਸਕਦੇ ਨੇ ਘੁੰਮਣ ਲਈ ਇੱਥੇ ਇੱਕ ਬਹੁਤ ਵੱਡਾ ਸ਼ੌਪਿੰਗ ਮੋਲ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਸਹੂਲਤ ਸ਼ਾਮਿਲ ਹੈ ਪਾਰਕਾਂ ਬਣੀਆ ਹੋਈਆਂ ਨੇ ਇੱਥੇ ਮਨ ਪਰਚਾਵੇ ਲਈ ਮੇਲੇ ਲੱਗਦੇ ਹਨ ਖਾਣ ਪੀਣ ਦੀਆਂ ਅਲੱਗ ਅਲੱਗ ਚੀਜ਼ਾਂ ਮਿਲਦੀਆਂ ਹਨ ਜੋ ਸਿਰਫ ਸਾਡੇ ਖੇਤਰ ਵਿੱਚ ਮਸ਼ਹੂਰ ਹਨ ਇੱਥੇ ਬੱਚਿਆਂ ਨੂੰ ਬਹੁਤ ਹੀ ਸੁੰਦਰ ਝੂਲੇ ਬਣਾਏ ਹੋਏ ਹਨ ਜੋ ਕਿ ਸ਼ਾਮ ਦੇ ਟਾਈਮ ਇੱਥੇ ਬਹੁਤ ਰੌਣਕ ਮੇਲਾ ਵੇਖਣ ਨੂੰ ਮਿਲਦਾ ਹੈ